ਲਿਖਣ ਨੂੰ ਮੈਂ ਕੇਵਲ ਸ਼ੌਕ ਵਜੋਂ ਹੀ ਲਿਆ ਹੈ ਇਸਨੂੰ ਕੇਰੀਅਰ ਵੱਲ ਤੋਰਨ ਵੱਲ ਮੈਂ ਤਰਜੀਹ ਨਹੀਂ ਦੇ ਰਿਹਾ ਅਤੇ ਜੇਕਰ ਲਿਖਣ ਦੀ ਗੱਲ ਆਵੇ ਤਾਂ ਇਸਦਾ ਕੋਈ ਨਿਸ਼ਚਿਤ ਸਮਾਂ ਜਾਂ ਸਥਾਨ ਨਹੀਂ ਹੈ ਆਲ਼ੇ ਦੁਆਲੇ ਜੋ ਵੀ ਘਟਨਾ ਵਾਪਰਦੀਆਂ ਹਨ ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲਿਖ ਲੈਂਦਾ ਹਾਂ ਪ੍ਰੰਤੂ ਇਹ ਗੱਲ ਜਰੂਰੀ ਨਹੀਂ ਹੈ ਜੋ ਵੀ ਮੇਰੇ ਮਨ ਵਿੱਚ ਖਿਆਲ ਆਉਂਦਾ ਹੈ ਜਾਂ ਜਿਸ ਵਿਸ਼ੇ ਉੱਤੇ ਲਿਖਣ ਦੀ ਤਾਂਘ ਹੁੰਦੀ ਹੈ ਮੈਂ ਉਸ ਵਿਸ਼ੇ ਬਾਰੇ ਲਿਖਣ ਲਈ ਬੈਠ ਜਾਂਦਾ ਹਾਂ ਉਸ ਬਾਰੇ ਕੁਝ ਸਤਰਾਂ ਆਪਣੀ ਡਾਇਰੀ ਜਾਂ ਮੋਬਾਇਲ ਦੇ ਵਿੱਚ ਹੀ ਦਰਜ ਕਰ ਲੈਂਦਾ ਹਾਂ ਤਾਂ ਕਿ ਕਿਸੇ ਵਿਹਲੇ ਸਮੇਂ ਜਾਂ ਸ਼ਾਂਤ ਮਾਹੌਲ ਵਿੱਚ ਬੈਠ ਕੇ ਉਸ ਚੀਜ਼ ਨੂੰ ਹੋਰ ਵਧਾਇਆ ਜਾ ਸਕੇ ਅਤੇ ਜੇਕਰ ਇਹ ਦੇਖਣਾ ਹੋਵੇ ਕਿ ਲਿਖਣ ਦਾ ਸਥਾਨ ਕੀ ਹੈ ਤਾਂ ਇਹ ਵੀ ਕੋਈ ਨਿਸ਼ਚਿਤ ਸਥਾਨ ਨਹੀਂ ਹੈ ਪ੍ਰੰਤੂ ਕੁਝ ਹਾਲਤਾਂ ਅਜਿਹੀਆਂ ਨੇ ਜਿਹੜੀਆਂ ਲਿਖਣ ਦੇ ਅਨੁਸਾਰ ਹੀ ਹੋ ਜਾਂਦੀਆਂ ਹਨ ਜਿਵੇਂ ਕਿ ਆਲਾ ਦੁਆਲਾ ਬਿਲਕੁਲ ਸ਼ਾਂਤ ਹੋਵੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਇਸ ਨਾਲ ਸਾਡਾ ਇਕਾਗਰ ਚਿੱਤ ਹੋ ਜਾਂਦਾ ਹੈ ਅਤੇ ਲਿਖਣ ਵਿੱਚ ਜਾਂ ਖਿਆਲਾਂ ਦੀ ਆਮਦ ਵਿੱਚ ਆਉਣ ਵਿੱਚ ਕੋਈ ਵੀ ਤਕਲੀਫ਼ ਪੇਸ਼ ਨਹੀਂ ਹੁੰਦੀ ਹੈ